ਹੈਲੋ ਸਰ ਤੁਸੀਂ ਓਲਾ ਕੰਪਨੀ ਤੋਂ ਬੋਲ ਰਹੇ ਹੋ ਅਸੀਂ ਆਪਣੀ ਤੁਹਾਡੇ ਕੋਲੋਂ ਕੈਬ ਬੁੱਕ ਕਰਵਾਉਣੀ ਸੀ ਆਨੰਦਪੁਰ ਜਾਣਾ ਸਾਡੇ ਸਾਰੇ ਪਰਿਵਾਰ ਨੇ ਇਸ ਕਰਕੇ ਤੁਹਾਡੇ ਕੋਲੋਂ ਇੱਕ ਕੈਬ ਬੁੱਕ ਕਰਵਾਉਣੀ ਸੀ ਜਿਹੜਾ ਅਸੀਂ ਦਸ ਦਿਨ ਵਾਸਤੇ ਜਾਣਾ ਹੈ ਤੁਸੀਂ ਸਾਨੂੰ ਜੋ ਵੀ ਕਿਰਾਇਆ ਲਗਾਓਗੇ ਜੋ ਵੀ ਪੈਸੇ ਆ ਤੁਹਾਨੂੰ ਉਸ ਹਿਸਾਬ ਨਾਲ ਤੁਹਾਨੂੰ ਸਭ ਕੁਛ ਦੇਵਾਂਗੇ ਇਸ ਕਰਕੇ ਤੁਸੀਂ ਦਸ ਦਿਨਾਂ ਵਾਸਤੇ ਸਾਨੂੰ ਆਪਣੀ ਕੈਬ ਦਿਓ ਡਰਾਈਵ ਅਸੀਂ ਆਪ ਹੀ ਕਰਾਂਗੇ ਸਾਰੇ ਪਰਿਵਾਰ ਨੇ ਅਸੀਂ ਜਾਣਾ ਹੈ ਜੋ ਵੀ ਰਸਤੇ ਵਿੱਚ ਗੁਰਦੁਆਰੇ ਸਾਹਿਬ ਆਉਣਗੇ ਉਹਨਾਂ ਦੇ ਦਰਸ਼ਨ ਕਰਦੇ ਹੋਏ ਅੱਗੇ ਵਧਾਂਗੇ ਇਸ ਕਰਕੇ ਤੁਹਾਨੂੰ ਜਿਸ ਤਰ੍ਹਾਂ ਤੁਹਾਡੇ ਕੋਲੋਂ ਤੁਹਾਡੀ ਗੱਡੀ ਖੜਾਂਗੇ ਉਸ ਤਰ੍ਹਾਂ ਹੀ ਤੁਹਾਡੇ ਕੋਲ ਵਾਪਸ ਭੇਜਾਂਗੇ ਇਸ ਲਈ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਏਗੀ ਜੇ ਤੁਸੀਂ ਸਾਨੂੰ ਆਪਣੀ ਗੱਡੀ ਦਿਓਗੇ ਅਤੇ ਵਧੀਆ ਲੱਗੇਗਾ ਸਾਡੇ ਸਾਰੇ ਪਰਿਵਾਰ ਦੇ ਦਰਸ਼ਨ ਹੋ ਜਾਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ